ਹੈਲੋ ਮੈਂ ਮਨਦੀਪ ਗੱਲ ਕਰ ਰਿਹਾ ਹਾਂ ਮੈਂ ਤੁਹਾਡੀ ਟਰੈਵਲਿੰਗ ਏਜੰਸੀ ਦੀਪ ਟਰੈਵਲਰਜ਼ ਤੋਂ ਇੱਕ ਟੈਕਸੀ ਬੁੱਕ ਕੀਤੀ ਸੀ ਜਿਸ ਨੂੰ ਕਿ ਮੈਂ ਫਤਿਹਗੜ੍ਹ ਸਾਹਿਬ ਸਰਕਾਰੀ ਸਕੂਲ ਦੇ ਕੋਲ ਆਉਣ ਦੇ ਲਈ ਕਿਹਾ ਸੀ ਪਰ ਮੈਂ ਪਿਛਲੇ ਤੀਹ ਮਿੰਟਾਂ ਤੋਂ ਵੇਟ ਕਰ ਰਿਹਾ ਹਾਂ ਉੱਥੇ ਹੁਣ ਤੱਕ ਤੁਹਾਡਾ ਏਜੰਸੀ ਦਾ ਡਰਾਈਵਰ ਗੱਡੀ ਲੈ ਕੇ ਨਹੀਂ ਆਇਆ ਹਾਲਾਂਕਿ ਮੌਸਮ ਬਹੁਤ ਖ਼ਰਾਬ ਹੈ ਮੈਨੂੰ ਬਹੁਤ ਜਲਦਬਾਜ਼ੀ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਮੇਰੀ ਜੋਬ ਦੇ ਲਈ ਨਿਕਲਣਾ ਸੀ ਜੋ ਕਿ ਹੁਣ ਤੱਕ ਨਹੀਂ ਪਹੁੰਚਿਆ ਸੋ ਮੈਨੂੰ ਬਹੁਤ ਜ਼ਿਆਦਾ ਕਾਹਲੀ ਹੈ ਇਸ ਲਈ ਮੈਂ ਆਪ ਜੀ ਦੇ ਦੁਆਰਾ ਬੁੱਕ ਕੀਤੀ ਗਈ ਟੈਕਸੀ ਨੂੰ ਰੱਦ ਕਰ ਰਿਹਾ ਹਾਂ